ਸਾਡੀ ਰਸੋਈ ਵਿੱਚ ਐਗਜ਼ੋਸਟ ਫੈਨ ਗੈਸ ਚੁੱਲ੍ਹਾ ਸਿਲੰਡਰ ਫੈਨ ਚਿਮਨੀ ਮਿਕਸਰ ਜੂਸਰ ਗਰਾਈਂਡਰ ਫਰਿੱਜ ਅਤੇ ਛੋਟੀ ਜਿਹੀ ਪੈਂਟਰੀ ਆਦੀਆਂ ਚੀਜ਼ਾਂ ਮੌਜੂਦ ਹਨ ਇਨ੍ਹਾਂ ਸਾਰੀਆਂ ਨਵੀਆਂ ਤਕਨੀਕਾਂ ਨਾਲ ਪਹਿਲਾਂ ਨਾਲੋਂ ਰਸੋਈ ਦਾ ਵਿੱਚ ਕੰਮ ਕਰਨ ਦਾ ਤਜਰਬਾ ਵਿੱਚ ਬਹੁਤ ਤਬਦੀਲੀ ਆਈ ਹੈ ਐਗਜ਼ੋਸਟ ਫੈਨ ਕਾਰਨ ਰਸੋਈ ਦੇ ਵਿੱਚ ਕੰਮ ਕਰਦੇ ਹੋਏ ਹੁਣ ਗਰਮੀ ਨਹੀਂ ਲੱਗਦੀ ਕਿਉਂਕਿ ਉਹ ਸਾਰਾ ਅੰਦਰ ਦੀ ਗਰਮੀ ਨੂੰ ਬਾਹਰ ਕੱਢ ਦਿੰਦਾ ਹੈ ਜਿੱਥੇ ਪਹਿਲਾਂ ਕੰਮ ਕਰਨ ਦੇ ਲਈ ਚੁੱਲ੍ਹਾ ਬਹੁਤ ਟਾਈਮ ਲੈ ਲੈਂਦਾ ਸੀ ਅਤੇ ਅੱਜ ਕੱਲ੍ਹ ਗੈਸ ਚੁੱਲ੍ਹੇ ਨਾਲ ਉਹ ਕੰਮ ਵੀ ਅਸਾਨ ਹੋ ਗਿਆ ਹੈ ਚਿਮਨੀ ਕਰਕੇ ਰਸੋਈ ਦੇ ਅੰਦਰ ਬਿਲਕੁਲ ਵੀ ਧੂੰਆਂ ਨਹੀਂ ਹੁੰਦਾ ਜੂਸਰ ਦੇ ਮਦਦ ਨਾਲ ਮੈਂ ਰੋਜ਼ ਸਵੇਰ ਨੂੰ ਉੱਠ ਕੇ ਜੂਸ ਪੀਂਦਾ ਹਾਂ ਅਤੇ ਸਾਡੀ ਰਸੋਈ ਦੇ ਵਿੱਚ ਫਰਿੱਜ ਵੀ ਹੈ ਜਿਸ ਕਾਰਨ ਰਸੋਈ ਦਾ ਸਮਾਨ ਖਾਣ ਪੀਣ ਦੀਆਂ ਚੀਜ਼ਾਂ ਆਦਿ ਛੇਤੀ ਖਰਾਬ ਵੀ ਨਹੀਂ ਹੁੰਦੀਆਂ ਅਤੇ ਆਲੂ ਪਿਆਜ਼ ਆਦਿ ਸਮਾਨ ਰੱਖਣ ਦੇ ਲਈ ਅਸੀਂ ਪੈਂਟਰੀ ਵੀ ਬਣਾਈ ਹੋਈ ਹੈ